ਸਭਿਆਚਾਰਕ ਤੇ ਸਮਾਜਿਕ ਲਹਿਰਾਂ ਦਾ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਨਿਵੇਕਲਾ ਸਥਾਨ ਹੈ ਜਿਵੇ ਅਕਾਲੀ ਅਕਾਲੀ ਲਹਿਰ ਉਨੀ ਸੋ ਬਾਈ ਦੇ ਵਿੱਚ ਚੱਲੀ ਜਿਸ ਨੇ ਪੰਜਾਬ ਦੀ ਸਿੱਖੀ ਪੰਜਾਬ ਦੇ ਗੁਰਦੁਆਰਿਆਂ ਨੂੰ ਫਿਰ ਤੋਂ ਸਥਾਪਤ ਮੁੱਢਲੇ ਢੰਗ ਨਾਲ ਦੁਬਾਰੇ ਵਧੀਆ ਢੰਗ ਨਾਲ ਸਥਾਪਤ ਕੀਤਾ ਤੇ ਚਾਬੀਆਂ ਵਾਲਾ ਮੋਰਚਾ ਲਹਿਰ ਚੱਲੀ ਜਿਸਨੇ ਜਿਸ ਰਾਹੀਂ ਮਹਾਨਤਾਂ ਤੋਂ ਗੁਰਦੁਆਰੇ ਛੜਾਏ ਗਏ ਸੋ ਗੁਰਦੁਆਰਿਆਂ ਦੇ ਵਿੱਚ ਐਸ਼ ਪਰਸਤੀਆਂ ਕਰਨ ਲੱਗ ਗਏ ਸਨ ਇਨਾ ਲਹਿਰਾਂ ਰਾਹੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਸੇਧ ਮਿਲੀ ਅਤੇ ਲੋਕਾਂ ਨੇ ਇਹਨਾਂ ਸੱਭਿਅਕ ਲਹਿਰਾਂ ਦਾ ਸਾਥ ਵੀ ਦਿੱਤਾ ਅਕਾਲੀ ਲਹਿਰ ਉਨੀ ਸੋ ਬਾਈ ਦੇ ਵਿੱਚ ਜੋ ਹੋਂਦ ਵਿੱਚ ਆਈ ਸੀ ਉਸ ਲਹਿਰ ਰਾਹੀਂ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਜਿਸਦੇ ਪ੍ਰਧਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਣੇ ਅਤੇ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਉਹ ਅਕਾਲੀ ਲਹਿਰ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਏ ਸਨ